ਜਦੋਂ ਸਾਡੇ ਕੋਲ ਸਮੇਂ ਘੱਟ ਹੁੰਦਾ ਹੈ ਔਰ ਸਮੱਗਰੀ ਵੀ ਘੱਟ ਹੁੰਦੀ ਹੈ ਔਰ ਸਾਨੂੰ ਬੜੀ ਭੁੱਖ ਲੱਗੀ ਦੀ ਹੋਵੇ ਅਤੇ ਅਸੀਂ ਨਮਕੀਨ ਚਾਵਲ ਦਾ ਔਪਸ਼ਨ ਬਹੁਤ ਅੱਛਾ ਹੁੰਦਾ ਕਿਉਂਕਿ ਉਹਦੇ ਵਿੱਚ ਇੱਕ ਤਾਂ ਸਮੇਂ ਵੀ ਘੱਟ ਲੱਗਦਾ ਦੂਸਰਾ ਉਹਦੇ ਵਿੱਚ ਸਮੱਗਰੀ ਵੀ ਘੱਟ ਲੱਗਦੀ ਹੈ ਉਹਦੇ ਵਿੱਚ ਸਾਡੇ ਕੋਲ ਜਿਹੜੀ ਘਰ ਸਬਜ਼ੀਆਂ ਪਈ ਦੀ ਹੁੰਦੀ ਆ ਅਸੀਂ ਉਹਦੀ ਵਰਤੋਂ ਕਰਕੇ ਇੱਕ ਬਹੁਤ ਟੇਸਟੀ ਔਰ ਬਹੁਤ ਅੱਛੇ ਨਮਕੀਨ ਚਾਵਲ ਤਿਆਰ ਕਰ ਸਕਦੇ ਹਾਂ ਅਸੀਂ ਸਭ ਤੋਂ ਪਹਿਲਾਂ ਜ਼ੀਰੇ ਦਾ ਤੜਕਾ ਦੇਣਾ ਜ਼ੀਰੇ ਦਾ ਤੜਕਾ ਦੇ ਕੇ ਅਸੀਂ ਪਿਆਜ ਨੂੰ ਫਰਾਈ ਕਰਾਂਗੇ ਉਹਦੇ ਵਿੱਚ ਅਸੀਂ ਟਮਾਟਰ ਫਰਾਈ ਕਰਾਂਗੇ ਪਿਆਜ ਸਾਡੇ ਫਰਾਈ ਹੋ ਜਾਣਗੇ ਟਮਾਟਰ ਹੋ ਜਾਣਗੇ ਫਿਰ ਉਹਦੇ ਵਿੱਚ ਅਸੀਂ ਆਲੂ ਪਾ ਸਕਦੇ ਹਾਂ ਨਿਊਟਰੀ ਪਾ ਸਕਦੇ ਹਾਂ ਕੋਈ ਵੀ ਸਾਡੇ ਕੋਲ ਘਰ ਬਚੀ ਵੀ ਸਬਜ਼ੀਆਂ ਹੈ ਅਸੀਂ ਉਹ ਬਰੀਕ ਬਰੀਕ ਕੱਟ ਕੇ ਉਹਦੇ ਵਿੱਚ ਪਾ ਦੇਈਏ ਬਾਅਦ 'ਚ ਅਸੀਂ ਉਹਦੇ 'ਚ ਨਮਕ ਮਿਰਚ ਪਾ ਕੇ ਉਹਨੂੰ ਅੱਛੀ ਤਰ੍ਹਾਂ ਹਿਲਾ ਕੇ ਭੁੰਨ ਲੈਦੇ ਹਾਂ ਜਦੋਂ ਚੰਗੀ ਤਰ੍ਹਾਂ ਮਸਾਲਾ ਸਾਡਾ ਤਿਆਰ ਹੋ ਜਾਂਦਾ ਫਿਰ ਅਸੀਂ ਉਹਦੇ ਵਿੱਚ ਚਾਵਲ ਪਾਉਂਦੇ ਹਾਂ ਚਾਵਲ ਜੇ ਸਾਡੇ ਕੋਲ ਇੱਕ ਗਲਾਸ ਚਾਵਲ ਹੈ ਤਾਂ ਅਸੀਂ ਉਹਦੇ 'ਚ ਡੇਢ ਗਲਾਸ ਪਾਣੀ ਪਾਵਾਂਗੇ ਔਰ ਸਾਡੇ ਕੋਲ ਦੋ ਗਲਾਸ ਚਾਵਲ ਹੈ ਤਾਂ ਅਸੀਂ ਉਹਦੇ 'ਚ ਢਾਈ ਗਲਾਸ ਪਾਣੀ ਪਾਵਾਂਗੇ ਹਰ ਇੱਕ ਮਤਲਬ ਕਿ ਅੱਧਾ ਗਲਾਸ ਪਾਣੀ ਅਸੀਂ ਸਿਰਫ਼ ਹਰ ਗਲਾਸ ਪਿੱਛੇ ਪਾਉਣਾ ਹੈ ਔਰ ਫਿਰ ਅਸੀਂ ਉਹਨੂੰ ਇਕ ਜਾਂ ਦੋ ਵਿਸਲ ਕਰਵਾ ਕੇ ਇੱਕ ਵਿਸਲ ਪੂਰੀ ਕਰਵਾ ਕੇ ਔਰ ਇੱਕ ਅਸੀਂ ਹਾਫ ਵਿਸਲ ਸਟਾਰਟ ਹੋ ਕੇ ਉਸ ਨੂੰ ਅਸੀਂ ਗੈਸ ਬੰਦ ਕਰ ਦਿੰਦੇ ਹਾਂ ਔਰ ਬਾਅਦ 'ਚ ਅਸੀਂ ਉਹਦੇ 'ਚ ਹਰਾ ਧਨੀਆ ਪਾ ਕੇ ਅਸੀਂ ਉਹਨੂੰ ਕਿਸੀ ਵੀ ਅਚਾਰ ਨਾਲ ਦਹੀਂ ਨਾਲ ਇੰਨਜੋਆਏ ਕਰ ਸਕਦੇ ਹਾਂ ਇੱਕ ਤਾਂ ਸਾਡੀ ਭੁੱਖ ਵੀ ਮਿਟ ਜਾਵੇਗੀ ਸਾਡਾ ਸਮਾਂ ਵੀ ਬਚੇਗਾ ਔਰ ਸਾਡੇ ਕੋਲ ਜਿ ਜਿਹੜੀ ਸਮੱਗਰੀ ਆ ਉਹਦੇ ਵਿੱਚ ਹੀ ਅਸੀਂ ਆਪਣਾ ਪੂਰਾ ਤਿਆਰ ਕਰ ਸਕਦੇ ਹਾਂ